ਪੰਜ ਹਜ਼ਾਰ ਪੰਜ ਸੌ ਪਚਵੰਜਾ ਪੰਜ ਹਜ਼ਾਰ ਪੰਜ ਸੌ ਛੱਬੀ ਨੌਂ ਲੱਖ ਸਤਾਰਾਂ ਹਜ਼ਾਰ ਤਿੰਨ ਸੌ ਵੀਹ ਪੰਦਰਾਂ ਹਜ਼ਾਰ ਦੋ ਸੌ ਪੱਚੀ ਦਸ ਹਜ਼ਾਰ ਪੰਜ ਸੌ ਇੱਕ